ਇੱਕ ਵਾਰੀ ਅਸੀਂ ਸ਼ਿਮਲੇ ਆਪਣੇ ਫ਼ਰੈਂਡ ਦੀ ਮੈਰਿਜ 'ਤੇ ਜਾਣਾ ਸੀ ਤਾਂ ਕੀ ਹੋਇਆ ਅਸੀਂ ਉਰੋ ਗੱਡੀ ਲੈ ਕੇ ਨਿਕਲ ਗਏ ਸਾਰੇ ਦੋਸਤ ਇਕੱਠੇ ਹੋਏ ਵੇ ਸੀ ਤਾਂ ਅਸੀਂ ਪੁੱਛਦੇ ਪੁੱਛਾਂਦਿਆਂ ਹਿਮਾਚਲ ਪਹੁੰਚ ਗਏ ਪਰ ਸਾਨੂੰ ਉਹਨਾਂ ਦਾ ਘਰ ਨਹੀਂ ਲੱਭਿਆ ਜਿਹਨਾਂ ਦੇ ਅਸੀਂ ਵਿਆਹ 'ਤੇ ਗਏ ਸੀ ਅਸੀਂ ਅੱਧਾ ਘੰਟਾ ਉਨ੍ਹਾਂ ਦੇ ਘਰ ਦੇ ਕੋਲ਼ ਹੀ ਰਾਊਂਡ ਕੱਢਦੇ ਰਹੇ ਕੱਢਦੇ ਰਹੇ ਫਿਰ ਬਾਅਦ ਵਿੱਚ ਇੱਕ ਸਾਨੂੰ ਗੱਡੀ ਵਾਲਾ ਮਿਲਿਆ ਅਸੀਂ ਉਹਨੂੰ ਪੁੱਛਿਆ ਵੀ ਅਸੀਂ ਵਿਆਹ ਵਾਲਿਆਂ ਦੇ ਘਰ ਜਾਣਾ ਵੀ ਸਾਨੂੰ ਕਾਫ਼ੀ ਟਾਇਮ ਹੋ ਗਿਆ ਵੀ ਘੁੰਮ ਘੁੰਮਾ ਕੇ ਅਸੀਂ ਉਹੀ ਰਸਤੇ 'ਤੇ ਆਈ ਜਾ ਰਹੇ ਹਾਂ ਦੁਬਾਰਾ ਤਾਂ ਉਹਨੇ ਦੱਸਿਆ ਵੀ ਮੁੰਡੇ ਦਾ ਵਿਆਹ ਹੈ ਅਸੀਂ ਕਿਹਾ ਹਾਂ ਵੀ ਮੁੰਡੇ ਦਾ ਵਿਆਹ ਏ ਵੀ ਅਸੀਂ ਉਹਦੇ ਦੋਸਤ ਹਾਂ ਅਤੇ ਉਹਦਾ ਫੋਨ ਵੀ ਨਹੀਂ ਲੱਗ ਰਿਹਾ ਹੈੈਗਾ ਤਾਂ ਉਹ ਗੱਡੀ ਵਾਲਾ ਕਹਿੰਦਾ ਵੀ ਹਾਂਜੀ ਵੀ ਘਰ ਉਰੀਂ ਉਹਨਾਂ ਦਾ ਥੱਲੇ ਉੱਤਰ ਕੇ ਆ ਵੀ ਜੋ ਡੋਲੀ ਵਾਲੀ ਕਾਰ ਆ ਉਹ ਮੇਰੀ ਕਾਰ ਹੀ ਲੱਗਣੀ ਆ ਸਵੇਰ ਨੂੰ ਮੈਂ ਕਾਰ ਸਜਾ ਰਿਹਾਂ ਤਾਂ ਫਿਰ ਅਸੀਂ ਉੱਥੇ ਨੀਚੇ ਗਏ ਅਤੇ ਫਿਰ ਜਦੋਂ ਉਹਨਾਂ ਨੇ ਸਾਨੂੰ ਦੇਖਿਆ ਵੀ ਸਾਨੂੰ ਦੇਖ ਕੇ ਇੱਕਦਮ ਸ਼ੌਕ ਹੋ ਗਏ ਤਾਂ ਉਹ ਸਾਨੂੰ ਕਹਿੰਦੇ ਕਹਿੰਦੇ ਤੁਸੀਂ ਹੁਣ ਪਹੁੰਚੇ ਆਂ ਰਾਤ ਦੇ ਮੈਕਸੀਮਮ ਦੋ ਤਿੰਨ ਵੱਜ ਗਏ ਸੀ ਤਾਂ ਮੀਨਿੰਗ ਇੱਕ ਲੇਖੇ ਦਾ ਅਸੀਂ ਉਹਨਾਂ ਨੂੰ ਬਹੁਤ ਵੱਡਾ ਸਪ੍ਰਾਇਜ਼ ਦਿੱਤਾ ਸੀ ਪਰ ਰਸਤਾ ਉਲਝਣ ਦੇ ਕਾਰਨ ਸਾਨੂੰ ਬਹੁਤ ਜ਼ਿਆਦਾ ਟਾਇਮ ਲੱਗ ਗਿਆ ਸੀ